ਮੈਂ ਮਮਤਾ ਦੇਵੀ ਪਿੰਡ ਮਾਧੋਪੁਰ ਵਾਸੀ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਅਤੇ ਮੇਰੇ ਪਰਿਵਾਰ ਨੇ ਸਲਾਹ ਕੀਤੀ ਕਿ ਅਸੀਂ ਵੀ ਕਿਤੇ ਘੁੰਮਣ ਦਾ ਮਨ ਬਣਾਇਆ ਅਸੀਂ ਸ੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਜਾਣ ਦੀ ਤਿਆਰੀ ਕਰਨ ਲੱਗੇ ਉਸ ਸੰਬੰਧ ਵਿੱਚ ਮੈਂ ਆਪਣੀ ਸਹੇਲੀ ਨੂੰ ਪੁੱਛਿਆ ਤਾਂ ਉਹ ਵੀ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ ਸਾਡੇ ਇੱਥੇ ਉਹਨਾਂ ਦੇ ਪਰਿਵਾਰ ਨੇ ਇਕੱਠੇ ਕੈਬ ਬੁੱਕ ਕਰ ਲਈ ਅਸੀਂ ਉੱਥੇ ਪੁੱਜ ਕੇ ਫਿਰ ਅਸੀਂ ਉੱਥੇ ਇੱਕ ਕਿਰਾਏ ਦੀ ਕਾਰ ਦੀ ਬੁਕਿੰਗ ਔਨਲਾਈਨ ਕੀਤੀ ਅਸੀਂ ਉਸ ਕਾਰ ਦਾ ਕਿਰਾਇਆ ਵੀ ਦਿੱਤਾ ਕਿਰਾਇਆ ਜਦੋਂ ਅਸੀਂ ਕਾਰ ਵਾਲੇ ਨੂੰ ਪੁੱਛਿਆ ਕਿ ਸਾਡਾ ਕਿੰਨਾ ਕਰਾਇਆ ਕਿੰਨਾਂ ਕਿਰਾਇਆ ਲੱਗੇਗਾ ਉਸ ਨੇ ਦੱਸਿਆ ਕਿ ਤੁਸੀਂ ਮੈਨੂੰ ਦੋ ਹਜ਼ਾਰ ਰੁਪਏ ਕਿਰਾਇਆ ਦੇਣਾ ਹੈ ਜਿਸ ਵਿੱਚ ਪੈਟਰੋਲ ਤੁਸੀਂ ਪਾਉਣਾ ਹੈ ਉਹਨਾਂ ਨੇ ਸਾਡੇ ਕੋਲੋਂ ਕਾਰ ਦੀ ਅੱਧੀ ਰਕਮ ਜਮ੍ਹਾਂ ਕਰ ਲਈ ਜਿਹੜੀ ਕਿ ਸਾਨੂੰ ਦੇਣੀ ਬਣਦੀ ਸੀ ਕਿਉਂਕਿ ਅਸੀਂ ਬਾਹਰ ਕਿਤੇ ਜਗ੍ਹਾ 'ਤੇ ਗਏ ਸੀ ਜਿਥ ਜਿੱਥੇ ਸਾਡੀ ਬਾਤ ਚੀਤ ਨਹੀਂ ਹੋ ਰਹੀ ਸੀ ਉਹ ਸਾਡੇ 'ਤੇ ਕਿਸ ਤਰ੍ਹਾਂ ਯਕੀਨ ਕਰਦਾ ਇਸ ਲਈ ਅਸੀਂ ਕਾਰ ਦੀ ਪੇਮੈਂਟ ਜਮ੍ਹਾਂ ਕਰਾਈ ਅਸੀਂ ਉਹਨਾਂ ਕੋਲੋਂ ਕਾਰ ਲਈ ਅਸੀਂ ਘੁੰਮਣ ਚਲੇ ਗਏ ਅਸੀਂ ਤਿੰਨ ਚਾਰ ਦਿਨ ਘੁੰਮਦੇ ਰਹੇ ਔਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਾਨੂੰ ਸਾਡੇ ਕੋਲੋਂ ਇਹ ਪੈਸੇ ਵਸੂਲੇ ਗਏ ਅਸੀਂ ਚਾਰ ਪੰਜ ਦਿਨ ਉੱਥੇ ਘੁੰਮ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਇਲਾਕੇ ਵਿੱਚ ਜਗ੍ਹਾ ਸਨ ਜੰਮੂ ਕਟਰਾ ਸ਼੍ਰੀਨਗਰ ਆਦਿ ਥਾਵਾਂ 'ਤੇ ਘੁੰਮੇ ਅਸੀਂ ਭਰਪੂਰ ਆਨੰਦ ਲਿਆ ਸਾਡੇ ਪਰਿਵਾਰ ਨੇ ਵੀ ਖੂਬ ਇੰਜੋਏ ਕੀਤਾ ਅਤੇ ਮੇਰੀ ਸਹੇਲੀ ਨੇ ਵੀ ਬੜਾ ਇੰਜੋਏ ਕੀਤਾ ਧੰਨਵਾਦ